ਜਾਨਵਰਾਂ ਦੇ ਉਤਪਾਦਾਂ ਦੀ ਪ੍ਰਕ੍ਰਿਆ ਕਰਨ ਦੇ ਕੁਛ ਆਮ ਤਰੀਕੇ ਕੀ ਹਨ ਜਾਨਵਰ ਜਿਸ ਤਰ੍ਹਾਂ ਕਿ ਗਾਂ ਮੱਝ ਬੱਕਰੀ ਲੈ ਲਓ ਵਧੀਆ ਖੁਰਾਕ ਦਿੱਤੀ ਜਾਵੇ ਉਹਨਾਂ ਨੂੰ ਤਾਂ ਉਹ ਵਧੀਆ ਅੱਗੇ ਤੋਂ ਅੱਗੇ ਉਤਪਾਦ ਦੇਣਗੇ ਦੁੱਧ ਦਹੀਂ ਪਨੀਰ ਮੱਖਣ ਸਭ ਵਧੀਆ ਕੁਆਲਿਟੀ ਕਿਸਮ ਦਾ ਮਿਲੇਗਾ ਵਧੀਆ ਕਿਸਮ ਦੀ ਜਾਨਵਰਾਂ ਨੂੰ ਖੁਰਾਕ ਦੇਵੋ ਇੱਕ ਜਾਨਵਰ ਨੂੰ ਖਰੀਦਣ ਦੇ ਲਈ ਉਸਦੇ ਰੰਗ ਰੂਪ ਗੁਣਾਂ ਨੂੰ ਦੇਖਿਆ ਜਾਂਦਾ ਹੈ ਉਸਨੂੰ ਕਿਸ ਉਸਦੀ ਕਿਸਮ ਨੂੰ ਦੇਖ ਕੇ ਉਸ 'ਤੇ ਵਿਚਾਰ ਕੀਤਾ ਜਾਵੇਗਾ ਉਹ ਉਤਪਾਦ ਕੀਤਾ ਜਾਵੇਗਾ ਤਾਂ ਕਿ ਪੈਸਾ ਵੱਧ ਤੋਂ ਵੱਧ ਕਮਾਇਆ ਜਾਏ ਉਤਪਾਦ ਕਦੋਂ ਵਧੀਆ ਹੋਵੇਗਾ ਜਦੋਂ ਆਪਾਂ ਉਸਦੀ ਖੁਰਾਕ ਦਾ ਧਿਆਨ ਰੱਖਿਆ ਜਾਵੇਗਾ ਉਸ ਨੂੰ ਸਮੇਂ ਸਮੇਂ 'ਤੇ ਟੀਕਾਕਰਨ ਦਿੱਤਾ ਜਾਵੇਗਾ ਉਸ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਉਸਦੀ ਸਾਫ਼ ਸੰਭਾਈ ਸਫਾਈ ਵੱਲ ਧਿਆਨ ਦਿੱਤਾ ਜਾਏਗਾ ਸਮੇਂ ਸਮੇਂ 'ਤੇ ਚੈੱਕਅਪ ਕੀਤਾ ਜਾਏਗਾ ਤਾਂ ਹੀ ਵਧੀਆ ਰਿਸਪਾਂਸ ਅੱਗੇ ਉਹ ਦਏਗਾ ਅਤੇ ਅੱਗੇ ਤੋਂ ਅੱਗੇ ਪੈਸਾ ਵੱਧ ਤੋਂ ਵੱਧ ਆਪਾਂ ਕਮਾ ਸਕਦੇ ਹਾਂ